ਹੈਲੋ ਹਾਂ ਹੈਲੋ ਹਾਂਜੀ ਵਧੀਆ ਤੂੰ ਸੁਣਾ ਕਿੱਦਾਂ ਹੋਰ ਕੀ ਕਰਦੀ ਆ ਬਸ ਯਾਰ ਬਿਜੀ ਪੜ੍ਹਾਈ ਖਤਮ ਹੋਈ ਆ ਅਤੇ ਫਿਰ ਵਿਹਲੇ ਹਾਂ ਘਰ ਹੀ ਹੁੰਦੀ ਹਾਂ ਤੂੰ ਦੱਸ ਕੀ ਹਾਲ ਚਾਲ ਤੇਰਾ

ਆਹੋ ਹੁਣ ਡਿਗਰੀ ਵੀ ਖ਼ਤਮ ਹੋਈ ਆ ਹੁਣ ਕਰੀਏ ਕੁਛ ਕੀ ਅੱਛਾ ਹਾਂ ਹੂੰ ਕਰ ਲਾ ਮੈਨੂੰ ਤਾਂ ਪਰ ਆਉਂਦੀ ਨਹੀਂ ਹੂੰ ਕੋਈ ਨਹੀਂ ਚਲ ਠੀਕ ਆ ਚਲ ਠੀਕ ਆ ਮੈਂ ਸ਼ਾਮੀ ਦੇਖਦੀ ਹਾਂ ਆਉਂਦੀ ਹਾਂ ਤੇਰੇ ਵੱਲ ਚਲ ਠੀਕ ਆ ਓਕੇ